ਮੁਢਲੇ ਕੁਝ ਸਮਿਆਂ ਤੋਂ ਹੀ ਭਾਰਤ ਅਤੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਘਰੇਲੂ ਨੁਸਖਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਸਾਡੇ ਵਾਲਾਂ ਅਤੇ ਚਮੜੀ ਲਈ ਕਾਫੀ ਲਾਭਦਾਇਕ ਹੁੰਦੇ ਹਨ ਜਿਨ੍ਹਾਂ ਵਿੱਚ ਵਾਲਾਂ ਵਾਸਤੇ ਸਰਸੋਂ ਦਾ ਤੇਲ ਦਹੀਂ ਐਲੋ ਵੇਰਾ ਚੋਲਾਂ ਦਾ ਪਾਣੀ ਪ੍ਰਮੁੱਖ ਹਨ ਚਮੜੀ ਵਾਸਤੇ ਕੋਫੀ ਦਾ ਪੈਕ ਐਲੋ ਵੇਰਾ ਮੁਲਤਾਨੀ ਮਿੱਟੀ ਵੇਸਣ ਦਾ ਘੋਲ ਨਾਰੀਅਲ ਦਾ ਤੇਲ ਅਤੇ ਕੱਚਾ ਦੁੱਧ ਅਤੇ ਹਲਦੀ ਵਰਗੇ ਕਈ ਨੁਸਖਿਆਂ ਦਾ ਉਪਯੋਗ ਕੀਤਾ ਜਾਂਦਾ ਹੈ